ਸਾਡੀ ਪੰਜਾਬੀ ਭਾਸ਼ਾ ਹੁਣ ਸਰਕਾਰੀ ਭਾਸ਼ਾ ਹਿੰਦੀ ਨਾਲ ਤੁਲਨਾ ਕਰ ਰਹੀ ਹੈ ਕਿਉਂਕਿ ਪੰਜਾਬ ਅੰਦਰ ਹਰ ਸ਼ਹਿਰ ਹਰ ਚੌਂਕ ਚੌਰਸਤੇ ਰਸਤੇ ਅਤੇ ਲੰਮੇ ਰੂਟਾਂ ਉੱਤੇ ਲੱਗੇ ਹੋਏ ਸਾਈਨ ਬੋਰਡਾਂ ਉੱਪਰ ਪੰਜਾਬੀ ਪਹਿਲੇ ਨੰਬਰ 'ਤੇ ਲਿਖੀ ਹੋਈ ਹੈ ਸਰਕਾਰੀ ਦਫ਼ਤਰਾਂ ਵਿੱਚ ਵੀ ਪੰਜਾਬੀ ਭਾਸ਼ਾ ਵਿੱਚ ਕੰਮ ਹੋ ਰਿਹਾ ਹੈ ਦਫ਼ਤਰਾਂ ਤੋਂ ਅੱਗੇ ਸਕੂਲਾਂ ਕਾਲਜਾਂ ਨੂੰ ਵੀ ਪੰਜਾਬੀ ਭਾਸ਼ਾ ਵਿੱਚ ਨੋਟਿਸ ਕੀਤ ਜਾਰੀ ਕੀਤੇ ਜਾਂਦੇ ਹਨ ਸਕੂਲਾਂ ਵਿੱਚ ਪੰਜਾਬੀ ਪਹਿਲ ਦੇ ਅਧਾਰ 'ਤੇ ਪੜ੍ਹਾਈ ਜਾ ਰਹੀ ਹੈ ਦਫ਼ਤਰਾਂ ਦੁਕਾਨਾਂ ਅ ਵੱਡੇ ਵੱਡੇ ਮੋਲ ਜਾਂ ਰੈਸਟੋਰੈਂਟਾਂ ਦੇ ਨਾਂ ਵੀ ਪੰਜਾਬੀ ਵਿੱਚ ਲਿਖੇ ਜਾ ਰਹੇ ਹਨ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਬਹੁਤ ਸੰਜੀਦਾ ਹੋ ਰਹੇ ਹਾਂ ਸਕੂਲਾਂ ਮੋਬਾਇਲ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਹੋ ਰਹੀ ਹੈ ਲੋਕ ਆਪਣੀ ਪਿਆਰੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਾਗਰੂਕ ਹੋ ਰਹੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਆਪਣੀ ਮਾਂ ਬੋਲੀ ਨੂੰ ਸਤਿਕਾਰ ਦੇ ਰਹੇ ਹਨ ਪੰਜਾਬ ਸਰਕਾਰ ਵੀ ਇਸ ਪ੍ਰਤੀ ਕਈ ਉਪਰਾਲੇ ਕਰ ਰਹੀ ਹੈ